ਹਾਂਜੀ ਮੈਂ ਆਪਣੇ ਸਕੂਲ ਦੀ ਪੜ੍ਹਾਈ ਸਮੇਂ ਅਤੇ ਦੀ ਪੜ੍ਹਾਈ ਸਮੇਂ ਕਲਾ ਪ੍ਰਦਰਸ਼ਨੀਆਂ ਦੇ ਵਿੱਚ ਗਈ ਹਾਂ ਜਿੱਥੇ ਵਿੱਚ ਜਿਹਦੇ ਆ ਇੱਕ ਥੀਮ ਹੁੰਦਾ ਸੀ ਜਿਵੇਂ ਕਈਆਂ ਦਾ ਪੰਜਾਬੀ ਕ ਵਿਰਸੇ ਨਾਲ ਸ ਸੰਬੰਧਿਤ ਹੋ ਗਿਆ ਕਈ ਵਾਰ ਇਤਿਹਾਸ ਨਾਲ ਸੰਬੰਧਿਤ ਹੋ ਗਿਆ ਵਿਗਿਆਨ ਨਾਲ ਸੰਬੰਧਿਤ ਹੋ ਗਿਆ ਇਹੋ ਜਿਹੀਆਂ ਕਲਾ ਪ੍ਰਦਰਸ਼ਨੀਆਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਜੋ ਕਿ ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਆਪ ਸਾਡਾ ਸੱਭਿਆਚਾਰ ਕੀ ਹੈ ਸਾਡਾ ਵਿਰਸਾ ਕੀ ਆ ਆਪਣੇ ਵਿਰਾਸਤ ਦਾ ਪਤਾ ਲੱਗਦਾ ਇਹ ਕਲਾ ਪ੍ਰਦਰਸ਼ਨੀਆਂ ਬੱਚਿਆਂ ਨੂੰ ਇਹਨਾਂ ਦਾ ਦੌਰਾ ਕਰਵਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਬੱਚੇ ਆਪਣੇ ਵਿਰਾਸਤ ਨਾਲ ਜੁੜਦੇ ਨੇ ਇਹਨਾਂ ਰਾਹੀਂ ਕਿਉਂਕਿ ਅਸ ਉੱਥੇ ਉਹ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਨੇ ਜੋ ਸਾਨੂੰ ਆਮ ਘਰਾਂ ਵਿੱਚ ਨਹੀਂ ਦੇਖਣ ਨੂੰ ਮਿਲਦੀਆਂ ਅਤੇ ਮੈਨੂੰ ਸਭ ਤੋਂ ਵਧੀਆ ਪ੍ਰਦਰਸ਼ਨੀ ਜੋ ਆਪਣੇ ਜੀਵਨ ਵਿੱਚ ਲੱਗੀ ਉਹ ਜਦੋਂ ਅਸੀਂ ਸਕੂਲ ਦੇ ਵਿੱਚ ਸੀ ਅਤੇ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਸੀ ਪੁਰਾਣੇ ਛੱਜ ਦਿਖਾਏ ਗਏ ਅਤੇ ਬਹੁਤ ਇਹੋ ਜਿਹੀ ਚੀਜ਼ਾਂ ਜਿਹਨਾਂ ਬਾਰੇ ਨਹੀਂ ਸੀ ਗਿਆਨ ਅਤੇ ਉਹਨਾਂ ਨੂੰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਉਹ ਅਸੀਂ ਆਮ ਨਹੀਂ ਦੇਖ ਪਾਉਂਦੇ ਪੁਰਾਣੇ ਰੇਡੀਓ ਪੁਰਾਣਾ ਪੁਰਾਣਾ ਸੱਭਿਆਚਾਰ ਬਹੁਤ ਚੀਜ਼ਾਂ ਦੇਖਣ ਨੂੰ ਮਿਲੀਆਂ ਅਤੇ ਅਸੀਂ ਬਹੁਤ ਉਤਸੁਕਤਾ ਨਾਲ ਗਏ ਅਤੇ ਸਾਡੀ ਉਤਸੁਕਤਾ ਨੂੰ ਉੱਥੇ ਬਹੁਤ ਜ਼ਿਆਦਾ ਹੋਰ ਚੰਗਾ ਅਨੁਭਵ ਮਿਲਿਆ ਅਤੇ ਦੇਖਣ ਨੂੰ ਐਂ ਜੀਅ ਕਰਦਾ ਕਿ ਕਿਧਰੇ ਹੋਰ ਜੇ ਹੋਈ ਇਹੋ ਜਿਹੀ ਪ੍ਰਦਰਸ਼ਨੀ ਤਾਂ ਜ਼ਰੂਰ ਜਾਵਾਂਗੇ ਅਤੇ ਭਵਿੱਖ ਵਿੱਚ ਜੇ ਕਿਸੇ ਐਕਸਪੋਜ਼ 'ਤੇ ਜਾਣਾ ਚਾਹੁੰਦੇ ਹਾਂ ਤਾਂ ਇਸੇ ਨਾਲ ਸੰਬੰਧਿਤ ਹੀ ਪੰਜਾਬ ਨਾਲ ਸੰਬੰਧਿਤ ਹੋਵੇ ਸਾਡੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਹੋਵੇ